ਬੇਰੁਜ਼ਗਾਰੀ ਪੰਜਾਬ ਦੇ ਅੰਦਰ ਇਸ ਪੱਧਰ 'ਤੇ ਪੈਰ ਪਸਾਰ ਰਹੀ ਹੈ ਕਿ ਸਾਡੇ ਬੱਚੇ ਬੱਚੀਆਂ ਬਹੁਤ ਉੱਚੇ ਪੱਧਰ ਦੀ ਵਿੱਦਿਆ ਹਾਸਲ ਕਰਨ ਦੇ ਬਾਵਜੂਦ ਵੀ ਵਿਹਲੇ ਬੈਠੇ ਨੇ ਜਾਂ ਸਾਡੇ ਬੱਚੇ ਬੱਚੀਆਂ ਦਾ ਵਿਦੇਸ਼ ਦੇ ਵਿੱਚ ਪਲਾਇਨ ਹੋ ਰਿਹਾ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਵੱਡੇ ਪੱਧਰ 'ਤੇ ਬੱਚੇ ਬਾਹਰ ਜਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਅੰਦਰ ਕਿੱਤਾ ਮੁਖੀ ਸਿੱਖਿਆ ਜਿਵੇਂ ਤਰਖਾਣ ਪਲੰਬਿੰਗ ਸਲਾਈ ਪੋਲਟਰੀ ਪਸ਼ੂ ਪਾਲਣ ਅਤੇ ਹੋਰ ਕਿੱਤਾ ਮੁਖੀ ਸਿੱਖਿਆਵਾਂ ਨੂੰ ਪਹਿਲ ਦੇ ਕੇ ਬੱਚਿਆਂ ਨੂੰ ਇਸ ਪਾਸੇ ਤੋਰਿਆ ਜਾ ਰਿਹਾ ਹੈ ਜਿਸ ਦੇ ਨਾਲ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਘਟੇਗੀ ਬੱਚਿਆਂ ਦੇ ਵਿੱਚ ਕਮਾਈ ਕਰਨ ਦਾ ਜਾਂ ਪੈਸੇ ਨੂੰ ਕਮਾਉਣ ਦਾ ਸਾਧਨ ਬਣੇਗਾ ਬੇਰੁਜ਼ਗਾਰੀ ਘਟਣ ਦੇ ਨਾਲ ਬੱਚਿਆਂ ਦੇ ਵਿੱਚ ਆਤਮ ਵਿਸ਼ਵਾਸ ਦਾ ਪੱਧਰ ਵਧੇਗਾ ਅਤੇ ਜਿੱਥੇ ਲੜਾਈ ਝਗੜਾ ਫਸਾਦ ਆਦਿਕ ਵੱਧਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਗਿਰਾਵਟ ਆਵੇਗੀ ਇਸ ਕਰਕੇ ਕਿੱਤਾ ਮੁਖੀ ਸਿੱਖਿਆ ਸਕੂਲਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਹੋਰ ਪਸਾਰਨ ਦੀ ਲੋੜ ਹੈ ਅਤੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਨੂੰ ਵਧਾਇਆ ਜਾਣਾ ਅਤੀ ਜ਼ਰੂਰੀ ਹੈ